ਵੱਡੀ ਗਿਣਤੀ ਬਾਰੀ ਕਾਰੋਬਾਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਛੋਟੇ ਕਿਸਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਹੋਏ ਹਨ ਕਿਉਂਕਿ ਵੱਡੇ ਖੇਤੀਬਾੜੀ ਕਿਸਾਨਾਂ ਕੋਲ ਵੱਧ ਆਧੁਨਿਕ ਮਸ਼ੀਨਰੀਆਂ ਅਤੇ ਵੱਧ ਆਧੁਨਿਕ ਵੱਡੇ ਸੰਦ ਹੁੰਦੇ ਹਨ ਤਾਂ ਉਹ ਛੋਟੇ ਕਿਸਾਨਾਂ ਕੋਲ ਨਹੀਂ ਹੁੰਦੇ ਅਤੇ ਅੱਜ ਕੱਲ੍ਹ ਛੋਟੇ ਕਿਸਾਨ ਤਬ ਕਰਜ਼ੇ ਹੇਠਾਂ ਦੱਬ ਰਹੇ ਹਨ ਅਤੇ ਵੱਡੇ ਕਿਸਾਨ ਅੱਗੇ ਵੱਧ ਰਹੇ ਹਨ ਕਿਉਂਕਿ ਛੋਟੇ ਕਿਸਾਨਾਂ ਕੋਲ ਕਰਜ਼ਾ ਜ਼ਿਆਦਾ ਹੁੰਦਾ ਹੈ ਸਿਰ ਉੱਤੇ ਕਰਜ਼ਾ ਜ਼ਿਆਦਾ ਹੁੰਦਾ ਹੈ ਅਤੇ ਉਹਨਾਂ ਦੀ ਆਮਦਨ ਘੱਟ ਹੁੰਦੀ ਹੈ ਰਹਿੰਦੀ ਖ਼ੂੰਹਦੀ ਕਸਰ ਹੈ ਜੋ ਐਮ ਐਸ ਪੀ ਘਟ ਰਹੀ ਹੈ ਅਤੇ ਟੈਕਸਾਂ ਵੱਲ ਜਾ ਕੇ ਵੱਡੇ ਸੇ ਸੈਲਰਾਂ ਵਿੱਚ ਆਪਣਾ ਆਪਣਾ ਆਪਣਾ ਝੋਨਾ ਕਣਕ ਵੱਧ ਰੇਟਾਂ 'ਤੇ ਵੇਚ ਰਹੇ ਹਨ ਪਰ ਛੋਟੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੀ ਵੇਚਣਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਉਹਨਾਂ ਨੂੰ ਐਮ ਐਸ ਪੀ 'ਤੇ ਘੱਟ ਰੇਟਾਂ ਵਿੱਚ ਵੇਚਣਾ ਪੈ ਰਿਹਾ ਹੈ ਕਈ ਵਾਰ ਐਮ ਐਸ ਪੀ ਦੀ ਗਾਰੰਟੀ ਕਈ ਫਸਲਾਂ ਉੱਤੇ ਨਿਆਂ ਨਾ ਹੋਣ ਕਰਕੇ ਉਹਨਾਂ ਨੂੰ ਫਸਲ ਦੇ ਰੇਟ ਤੋਂ ਘੱਟ ਵੀ ਵੇਚਣਾ ਪੈ ਰਿਹਾ ਹੈ ਇਸ ਨਾਲ ਛੋਟੇ ਕਿਸਾਨਾਂ ਨੂੰ ਤਾਂ ਬਹੁਤ ਨੁਕਸਾਨ ਹੋ ਰਿਹਾ ਹੈ ਕਿਉਂਕਿ ਵੱਡੇ ਕਿਸਾਨ ਤਾਂ ਆਪਣੀ ਫਸਲ ਨੂੰ ਸਟੋਰ ਸਟੋਰ ਕਰਕੇ ਵੱਡੇ ਗੁਦਾਮਾਂ ਵਿੱਚ ਰੱਖ ਲੈਂਦੇ ਲੈ ਸਕਦੇ ਹਨ ਪਰ ਛੋਟੇ ਕਿਸਾਨਾਂ ਕੋਲ ਸਟੋਰ ਕਰਨ ਲਈ ਇੰਨੀ ਜਗ੍ਹਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਖੜ੍ਹੇ ਪੈਰ ਹੀ ਕਣਕ ਜਾਂ ਝੋਨੇ ਜਾਂ ਨਰਮਾ ਜਾਂ ਜਿਹਨਾਂ ਫਸਲਾਂ ਉੱਤੇ ਐਮ ਐਸ ਪੀ ਨਹੀਂ ਹੈ ਉਹਨਾਂ ਨੂੰ ਵੇਚਣਾ ਪੈਂਦਾ ਹੈ ਅਤੇ ਉਹਨਾਂ ਨੂੰ ਘੱਟ ਦਾਮ 'ਤੇ ਹੀ ਵੇਚਣਾ ਪੈਂਦਾ ਹੈ ਵੱਡੇ ਕਿਸਾਨ ਉਹਨਾਂ ਨੂੰ ਜਦੋਂ ਦਾਮ ਵਧਦਾ ਹੈ ਤਾਂ ਤਦ ਵੇਚ ਕੇ ਮੁਨਾਫਾ ਖੱਟ ਲੈਂਦੇ ਹਨ ਪਰ ਛੋਟੇ ਕਿਸਾਨਾਂ ਨੂੰ ਮੁਨਾਫਾ ਖੱਟਣ ਦਾ ਮੌਕਾ ਨਹੀਂ ਮਿਲਦਾ ਹਰੀ ਕ੍ਰਾਂਤੀ ਨੇ ਵੀ ਛੋਟੇ ਕਿਸਾਨਾਂ 'ਤੇ ਬਹੁਤ ਪ੍ਰਭਾਵ ਪਾਇਆ ਹੈ ਅੱਜ ਕੱਲ੍ਹ ਕਿਸਾਨ ਬਸ ਦੋ ਤਿੰਨ ਕੁ ਫਸਲਾਂ ਵਿੱਚ ਹੀ ਉਲਝ ਕੇ ਰਹਿ ਚੁੱਕੇ ਹਨ ਅਤੇ ਹੌਰ ਸਫਲ ਵੇ ਵੇਚਣ ਜਾਂ ਵੱਢ ਦਾ ਰਿਸਕ ਲੈਣਾ ਹੀ ਨਹੀਂ ਚਾਹੁੰਦੇ ਉਹ ਚਾਹੁੰਦੇ ਹਨ ਕਿ ਸਾਨੂੰ ਰਿਸਕ ਤੋਂ ਬਿਨਾਂ ਹੀ ਫ਼ਸਲ ਹੋ ਜਾਵੇ ਅਤੇ ਸਾਨੂੰ ਘਾਟਾ ਨਾ ਪਵੇ ਇਸ ਲਈ ਛੋਟਾ ਕਿਸਾਨ ਡਰਦਾ ਹੈ ਘਾਟਾ ਪੈਣ ਤੋਂ ਅਤੇ ਵੱਡੇ ਕਿਸਾਨ ਅੱਗੇ ਵਧ ਰਹੇ ਹਨ ਪਰ ਛੋਟੇ ਕਿਸਾਨ ਕਰਜ਼ੇ ਥੱਲੇ ਦੱਬ ਰਹੇ ਹਨ